ਨਮਸਕਾਰ ਸਰ ਬੇਨਤੀ ਹੈ ਕਿ ਮੇਰੇ ਬੱਚੇ ਦਾ ਜਨਮ ਪੰਜ ਅਕਤੂਬਰ ਨੂੰ ਇੱਕ ਫਾਜ਼ਿਲਕਾ ਦੇ ਨਿਜੀ ਹਸਪਤਾਲ ਵਿੱਚ ਹੋਇਆ ਹੈ ਅਤੇ ਉਸ ਦੇ ਜਨਮ ਰਜਿਸਟਰੇਸ਼ਨ ਫਾਰਮ ਵਿੱਚ ਉਸ ਦਾ ਜੋ ਭਾਰ ਹੈ ਉਹ ਗਲਤ ਲਿਖ ਦਿੱਤਾ ਗਿਆ ਹੈ ਜਿਸ ਨੂੰ ਅਸੀਂ ਸਹੀ ਕਰਵਾਣਾ ਚਾਹੁੰਦੇ ਹਾਂ ਅਤੇ ਉਸ ਦਾ ਭਾਰ ਜੋ ਲਿਖਿਆ ਗਿਆ ਸੀ ਉਹ ਹੈ ਦੋ ਕਿਲੋ ਅਤੇ ਸੱਤ ਸੌ ਗਰਾਮ ਪਰ ਐਕਚੁਅਲ ਵਿੱਚ ਉਸ ਦਾ ਭਾਰ ਜਨਮ ਸਮੇਂ ਤਿੰਨ ਕਿਲੋ ਸੀ ਇਸ ਰਿਕਾਰਡ ਨੂੰ ਅਪਡੇਟ ਕਰਨਾ ਹੈ ਜਿਸ ਲਈ ਪਲੀਸ ਤੁਸੀਂ ਮੈਨੂੰ ਮਾਰਗ ਦਰਸ਼ਨ ਕਰੋ ਕਿ ਇਸ ਰਿਕਾਰਡ ਨੂੰ ਭਾਰ ਜੋ ਗਲਤ ਲਿਖਿਆ ਗਿਆ ਹੈ ਉਸ ਨੂੰ ਬਦਲ ਕੇ ਸਹੀ ਭਾਰ ਲਿਖਣ ਲਈ ਕਿਸ ਤਰ੍ਹਾਂ ਦੇ ਪ੍ਰੋਸੀਜਰ ਵਿੱਚੋਂ ਗੁਜਰਨਾ ਪਵੇਗਾ ਅਤੇ ਇਸ ਦੇ ਨਾਲ ਮੈਂ ਹੋਸਪਿਟਲ ਜੋ ਹਸਪਤਾਲ ਵਿੱਚ ਉਸ ਦਾ ਜਨਮ ਹੋਇਆ ਸੀ ਉਸ ਵੱਲੋਂ ਦਿੱਤੇ ਗਏ ਜਨਮ ਸਮੇਂ ਅਤੇ ਉਸ ਦਾ ਭਾਰ ਜੋ ਜਨਮ ਸਮੇਂ ਸੀ ਉਹ ਮੈਂ ਪੂਰੇ ਪਰੂਫ ਵਜੋਂ ਨਾਲ ਲਿਖ ਕੇ ਭੇਜ ਰਹੀ ਹਾਂ ਅਤੇ ਜਿਸ ਨੂੰ ਅਪਡੇਟ ਕਰਕੇ ਉਸ ਦਾ ਨਵਾਂ ਜੋ ਸਹੀ ਭਾਰ ਹੈ ਉਸ ਨਾਲ ਇਸ ਨੂੰ ਅਪਡੇਟ ਕਰ ਦਿੱਤਾ ਜਾਵੇ ਤਾਂ ਜੋ ਕੱਲ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ